ਮੈਨੂੰ ਛੋਟੇ ਹੁੰਦੇ ਤੋਂ ਖਾਣਾ ਬਣਾਉਣ ਦਾ ਬਹੁਤ ਸ਼ੌਕ ਸੀ ਪਰ ਮੇਰੀ ਮਾਤਾ ਸ਼੍ਰੀ ਨੇ ਮੈਨੂੰ ਕਦੇ ਖਾਣਾ ਬਣਾਉਣ ਹੀ ਨਹੀਂ ਦਿੱਤਾ ਉਹ ਕਹਿੰਦੇ ਸੀ ਕਿ ਕਿਚਨ ਦੇ ਵਿੱਚ ਬਹੁਤ ਕੁਛ ਹੋ ਸਕਦਾ ਹੈ ਕਿਉਂਕਿ ਅੱਜ ਕੱਲ੍ਹ ਬਹੁਤ ਸਾਰੇ ਹਾਦਸੇ ਹੁੰਦੇ ਹਨ ਜਿਸਦੇ ਕਰਕੇ ਮੈਂ ਖਾਣਾ ਨਹੀਂ ਬਣਾ ਸਕਦੀ ਸੀ ਕਿਉਂਕਿ ਮੰਮਾ ਮਨ੍ਹਾ ਕਰਦੇ ਸੀ ਫਿਰ ਉਸ ਤੋਂ ਬਾਅਦ ਜਦੋਂ ਮੈਂ ਸਤਾਰਾਂ ਕੁ ਸਾਲ ਦੀ ਹੋਈ ਫਿਰ ਮੈਂ ਮੰਮਾ ਦੀ ਪ੍ਰਮਿਸ਼ਨ ਲੈ ਕੇ ਸੋਚਿਆ ਕਿ ਮੈਂ ਹੁਣ ਖਾਣਾ ਬਣਾਉਣਾ ਸ਼ੁਰੂ ਕਰਾਂਗੀ ਅਤੇ ਫਿਰ ਮੈਂ ਖਾਣਾ ਬਣਾਉਣਾ ਸ਼ੁਰੂ ਕੀਤਾ ਅਤੇ ਉਸ ਤੋਂ ਬਾਅਦ ਮੈਂ ਉਸ ਵਿੱਚ ਸਫ਼ਲ ਹੋਈ ਫਿਰ ਮੈਨੂੰ ਹਰ ਇੱਕ ਸਬਜ਼ੀਆਂ ਬਣਾਉਣੀ ਆਉਂਦੀ ਸੀ ਜਿਵੇਂ ਕਿ ਭਿੰਡੀ ਦੀ ਸ਼ਿਮਲਾ ਮਿਰਚ ਦੀ ਗੋਭੀ ਬੰਦ ਗੋਭੀ ਪੱਤਾ ਗੋਭੀ ਦੀ ਅਤੇ ਹਰ ਇੱਕ ਸ ਤਰ੍ਹਾਂ ਦੀ ਸਬਜ਼ੀ ਮੈਂ ਬਣਾਉਣੀ ਸ਼ੁਰੂ ਕਰਤੀ ਫਿਰ ਮੈਨੂੰ ਹੌਲੀ ਹੌਲੀ ਬਹੁਤ ਹੀ ਜ਼ਿਆਦਾ ਇਸ ਦੇ ਵਿੱਚ ਮਜ਼ਾ ਆਉਣ ਲੱਗ ਗਿਆ ਇਸ ਲਈ ਮੈਂ ਘਰ ਦਾ ਸਾਰਾ ਕੰਮ ਹੀ ਆਪਣੇ ਸਿਰ 'ਤੇ ਲੈ ਲਿਆ ਅਤੇ ਮੰਮਾ ਨੂੰ ਸਾਰੇ ਘਰ ਦੇ ਕੰਮਾਂ ਤੋਂ ਟੈਨਸ਼ਨ ਫ਼ਰੀ ਕਰਤਾ ਅਤੇ ਫਿਰ ਮੈਂ ਰੋਟੀ ਤੋਂ ਲੈ ਕੇ ਸਬਜ਼ੀ ਤੱਕ ਸਾਰਾ ਕੁਛ ਖੁ ਖੁਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਸਵੇਰ ਦੀ ਰੋਟੀ ਤੋਂ ਲੈ ਕੇ ਸ਼ਾਮ ਦੀ ਰੋਟੀ ਮੈਂ ਖੁਦ ਬਣਾਉਣੀ ਸ਼ੁਰੂ ਕਰ ਦਿੱਤੀ ਕੱਲ੍ਹ ਹੀ ਰੀਸੈਂਨਟਲੀ ਮੈਂ ਇੱਕ ਨਵੀਂ ਸਬਜ਼ੀ ਬਣਾਈ ਸੀਗੀ ਜੋ ਕਿ ਕਟਹਲ ਦੀ ਸਬਜ਼ੀ ਸੀਗੀ ਮੈਂ ਉਸ ਨੂੰ ਬਣਾ ਤਾਂ ਲਿੱਤਾ ਬਟ ਉਹ ਕ ਠੀਕ ਬਣੀ ਫਸਟ ਟਾਈਮ ਨ ਵਧੀਆ ਹੀ ਬਣੀ ਸੀਗੀ ਅਤੇ ਉਸ ਤੋਂ ਬਾਅਦ ਪਹਿਲਾਂ ਮੈਂ ਉਸਦੇ ਲਈ ਸਬਜ਼ੀਆਂ ਵਗੈਰਾ ਸਬਜ਼ੀ ਕੱਟ ਲਈ ਉਸ ਤੋਂ ਬਾਅਦ ਲ ਲ਼ਸਣ ਪਿਆਜ਼ ਦਾ ਤੜਕਾ ਬਣਾ ਕੇ ਉਸਦੇ ਵਿੱਚ ਪਾ ਕੇ ਫਿਰ ਉਸਦੇ ਬਾਅਦ ਕਟਹਲ ਪਾ ਤਾ ਸਬਜ਼ੀ ਦੇ ਵਿੱਚ ਦੈਨ ਉਸ ਨੂੰ ਕੁੱਕਰ ਦੇ ਬੰਦ ਕਰਕੇ ਸੀਟੀ ਮਰਾਤੀ ਅਤੇ ਉਹ ਵਧੀਆ ਬਣੀ ਸੀਗੀ ਬਟ ਮੈਨੂੰ ਇੰਨੀ ਜ਼ਿਆਦਾ ਅੱਛੀ ਨਹੀਂ ਲੱਗੀ ਸ਼ਾਇਦ ਮੈਂ ਦੂਸਰੀ ਵਾਰ ਜ਼ਿਆਦਾ ਹੀ ਵਧੀਆ ਬਣਾਵਾ